ਵੈਸੇ ਤਾਂ ਸਾਡੇ ਘਰ ਜਿਹੜੀ ਬਿਜਲੀ ਹੈ ਉਹ ਚੌਵੀ ਘੰਟੇ ਰਹਿੰਦੀ ਹੈ ਪਰ ਵੱਖ ਵੱਖ ਮੌਸਮਾਂ ਦੇ ਕਰਕੇ ਕਈ ਵਾਰੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਆ ਜਿੱਦਾਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਜ਼ਿਆਦਾ ਬਿਜਲੀ ਦੇ ਕੱਟ ਲੱਗਦੇ ਆ ਕਿਉਂਕਿ ਕ ਹਨੇਰੀਆਂ ਵਗੈਰਾ ਦੇ ਕਰਕੇ ਕਿਤੇ ਨਾ ਕਿਤੇ ਖਰਾਬੀ ਆ ਜਾਂਦੀ ਆ ਤਾਂ ਇਹਨਾਂ ਕੱਟਾਂ ਬਿਜਲੀ ਦੇ ਕੱਟਾਂ ਦੇ ਕਰਕੇ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਕਿਉਂਕਿ ਅਸੀਂ ਪੜ੍ਹਨਾ ਹੁੰਦਾ ਆ ਆਪਾਂ ਸਟੂਡੈਂਟ ਹੈ ਅਤੇ ਉਹਦੇ ਕਰਕੇ ਸਾਡੀ ਜਿਹੜੀ ਸਟੱਡੀ ਆ ਉਹ ਬ ਬਹੁਤ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਔਨਲਾਈਨ ਕਲਾਸਿਸ ਲੱਗਦੀਆਂ ਆ ਅਤੇ ਸਾਰੇ ਦੇ ਸਾਰੇ ਨੋਟਸ ਵਗੈਰਾ ਸਾਨੂੰ ਔਨਲਾਈਨ ਮਿਲਦੇ ਆ ਅਤੇ ਉਹਦੇ ਕਰਕੇ ਕੀ ਹੁੰਦਾ ਹੈ ਕਿ ਸਾਨੂੰ ਮੋਬਾਇਲ ਫੋਨ ਯੂਜ਼ ਕਰਨੇ ਪੈਂਦੇ ਆ ਜਾਂ ਫਿਰ ਲੈਪਟੋਪ ਯੂਜ਼ ਕਰਨੇ ਪੈਂਦੇ ਆ ਅਤੇ ਬਿਜਲੀ ਦੇ ਕੱਟ ਦੇ ਕਰਕੇ ਬੈਟਰੀ ਵਗੈਰਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਮੋਬਾਇਲ ਫੋਨਸ ਦੀ ਵੀ ਅਤੇ ਲੈਪਟੋਪ ਦੀ ਵੀ ਅਤੇ ਉਹਦੇ ਕਰਕੇ ਜਿਹੜੀ ਸਟੱਡੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਿਘਨ ਪੈਂਦਾ ਏ ਆ ਇਹਦੇ ਤੋਂ ਬਿਨਾਂ ਬਿਜਲੀ ਦੇ ਕੱਟ ਦੇ ਕਰਕੇ ਬਹੁਤ ਵਾਰੀ ਪਾਣੀ ਦੀ ਸਮੱਸਿਆ ਆਉਂਦੀ ਹੈ ਕਿਉਂਕਿ ਬਿਜਲੀ ਜਾਣ ਦੇ ਕਰਕੇ ਅਸੀਂ ਮੋਟਰ ਨਹੀਂ ਚਲਾ ਪਾਉਂਦੇ ਅਤੇ ਉਹਦੇ ਕਰਕੇ ਪਾਣੀ ਜਿਹੜਾ ਏ ਆ ਉਹ ਬਹੁਤ ਸਾਨੂੰ ਮੁਸ਼ਕਿਲ ਆਉਂਦੀ ਆ ਉਹਦੇ ਕਰਕੇ ਇਹਦੇ ਤੋਂ ਬਿਨਾਂ ਕੱਪੜੇ ਵਗੈਰਾ ਕਿਉਂਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਧੋਣੇ ਹੁੰਦੇ ਆ ਤਾਂ ਉਹਦੇ ਵਿੱਚ ਵੀ ਮੁਸੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅਤੇ ਇਹਦੇ ਤੋਂ ਬਿਨਾਂ ਕਿਉਂਕਿ ਅੱਜ ਕੱਲ੍ਹ ਹਰ ਇੱਕ ਚੀਜ਼ ਫੋਨ 'ਤੇ ਅਵੇਲੇਬਲ ਆ ਤਾਂ ਸ ਜਦੋਂ ਵੀ ਫੋਨ ਯੂਜ਼ ਕਰਨਾ ਹੁੰਦਾ ਏ ਆ ਤਾਂ ਉਹ ਤੋਂ ਬਾਅਦ ਉਹਦੀ ਬੈਟਰੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤਾਂ ਬਿਜਲੀ ਦੇ ਨਾ ਆਉਣ ਦੇ ਕਰਕੇ ਫੋਨ ਵਗੈਰਾ ਵੀ ਚਾਰਜ ਨਹੀਂ ਹੁੰਦੇ ਇਸ ਕਰਕੇ ਬਿਜਲੀ ਦੇ ਕੱਟਾਂ ਦੇ ਕਰਕੇ ਜਿਹੜਾ ਆਮ ਜਨਜੀਵਨ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ